ਹੈਲੋ ਅ ਮੈਮ ਨਵ ਸਤਿ ਸ਼੍ਰੀ ਅਕਾਲ ਮੈਂ ਅਰਸ਼ਦੀਪ ਸਿੰਘ ਬੋਲ ਰਿਹਾ ਸੀਗਾ ਸ ਸੈਂਟਰਲ ਯੂਨੀਵਰਸਿਟੀ ਪੰਜਾਬ ਤੋਂ ਅਤੇ ਮੈਂ ਯੋਗਾ ਅਤੇ ਮੈਂ ਯੋਗਾ ਕੋਰਸ ਬਾਰੇ ਪੁੱਛਣਾ ਸੀ ਤੁਹਾਡੇ ਤੋਂ ਤੁਸੀਂ ਸੁਨੀਤਾ ਮੋਰਯਾ ਜੀ ਬੋਲਦੇ ਹੋ ਅੱਛਾ ਜੀ ਅਤੇ ਮੈਨੂੰ ਨਾ ਪ੍ਰੋਪਰ ਇੱਕ ਸਟਰਕਚਰ ਦੱਸ ਦਿਓ ਵੀ ਤੁਹਾਡਾ ਕਿੱਦਾਂ ਅ ਦ ਯੋਗਾ ਦਾ ਕੰਮ ਹੋਣਾ ਹੈ ਵੀ ਮਤਲਬ ਕਿੱਦਾਂ ਤੁਸੀਂ ਸਿਖਾਉਗੇ ਤਾਂ ਪ੍ਰੋਪਰ ਤਰੀਕੇ ਨਾਲ ਇੱਕ ਵਾਰੀ ਦੱਸ ਦਿਓ ਮੈਨੂੰ ਇਸ ਬਾਰੇ ਸਾਰੀ ਡਿਟੇਲ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਮੈਂ ਸਟੂਡੈਂਟ ਐ ਐਕਚੁਲੀ ਮੈਂ ਪੜ੍ਹ ਵੀ ਰਿਹਾ ਸੀ ਨਾਲ ਦੀ ਨਾਲ ਅਤੇ ਸਟੱਡੀ ਦੇ ਵਿੱਚ ਮੈਨੂੰ ਲੱਗਦਾ ਕਿ ਮੈਂ ਸ਼ਾਮ ਦੀ ਟਾਈਮਿੰਗ ਦੇ ਵਿੱਚ ਸਹੀ ਰਹੂੰਗਾ ਮਤਲਬ ਛੇ ਜਾਂ ਸੱਤ ਤੋਂ ਵਿੱਚਕਾ ਵਿੱਚਕਾਰ ਸ਼ਾਮ ਨੂੰ ਅਤੇ ਮੇਰੇ ਨਾਲ ਕੁਛ ਹੋਰ ਵੀ ਦੋਸਤ ਨੇ ਜਿਹੜੇ ਕਹਿ ਰਹੇ ਸੀ ਵੀ ਅਸੀਂ ਕਰਾਂਗੇ ਬਾਕੀ ਮੈਨੂੰ ਪੱਕਾ ਨਹੀਂ ਪਤਾ ਵੀ ਉਨ੍ਹਾਂ ਨੇ ਇਸ ਵਿੱਚ ਜੁਆਇਨ ਕਰਨਗੇ ਵੀ ਨਹੀਂ ਲੇਕਿਨ ਬਟ ਹਾਂ ਮੈਨੂੰ ਲੱਗਦਾ ਇੱਕ ਇੱਕ ਦੋ ਹੋਣਗੇ ਜਿਹੜੇ ਨਾਲ ਜੁਆਇਨ ਕਰਨ ਨੂੰ ਤਿਆਰ ਨੇ ਅਤੇ ਇਹਨਾਂ ਬਾਰੇ ਤੁਸੀਂ ਦੱਸ ਦਿਓ ਮੜੀ ਫੀਸ ਕੀ ਹੋਏਗੀ ਪਰ ਪਰਸਨ ਦੀ ਹਾਂਜੀ ਹਾਂਜੀ ਹਾਂਜੀ ਅੱਛਾ ਜੀ ਨਾ ਜੀ ਹੋਰ ਤਾਂ ਕੁਛ ਕੋਸ਼ ਕੁਸ਼ਚਨ ਹੈ ਨਹੀਂ ਹਜੇ ਅਤੇ ਬਾਕੀ ਇੱਦਾਂ ਸੀਗਾ ਵੀ ਤੁਹਾਡਾ ਜਿਹੜਾ ਬਰਾਊਸ਼ਰ ਵਗੈਰਾ ਵੀ ਤੋ ਤੁਹਾਡੇ ਕੋਲ ਅਹੋ ਅ ਹੋਏਗਾ ਜੇ ਤੁਸੀਂ ਮੈਨੂੰ ਔਨਲਾਈਨ ਭੇਜ ਦਿਓ ਇੱਕ ਵਾਰੀ ਮੈਂ ਚੈੱਕ ਵੀ ਕਰ ਲਊਂਗਾ ਕਿੱਦਾਂ ਤੁਸੀਂ ਮਤਲਬ ਕਰਵਾਉਂਦੇ ਅਤੇ ਕਿੰਨੇ ਬੱਚੇ ਤੁਹਾਡੇ ਕੋਲ ਹੁਣ ਹੈਗੇ ਨੇ ਹਜੇ ਜਿਹੜੇ ਕਰ ਰਹੇ ਨੇ ਬੈਚ ਕਿੰਨੇ ਨੇ ਤੁਹਾਡੇ ਇਸ ਬਾਰੇ ਵੀ ਦੱਸ ਸਕਦੇ ਕੁਛ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਠੀਕ ਹੈ ਚਲੋ ਬਾਕੀ ਮੈਂ ਹੁਣ ਤੁਹਾਨੂੰ ਵਿਜਿਟ ਕਰੂੰਗਾ ਅਤੇ ਫਿਰ ਮੈਂ ਬਾਕੀ ਅ ਵ ਜੋ ਵੀ ਚੀਜ਼ਾਂ ਨੇ ਹੋਰ ਹੋਣਗੀਆਂ ਮੈਂ ਤੁਹਾਡੇ ਨਾਲ ਆਕੇ ਹੀ ਪਰਸਨਲੀ ਗੱਲ ਕਰੂੰਗਾ ਫਿਰ ਅੱਜ ਹੁਣ ਲਈ ਬਹੁਤ ਆ ਹੈ ਨਾ ਜੀ ਅਤੇ ਬਾਕੀ ਫਿਰ ਮੈਂ ਤੁਹਾਨੂੰ ਹਾਂਜੀ ਠੀਕ ਹੈ ਜੀ ਓਕੇ ਥੈਂਕਯੂ ਮੈਮ ਹਾਂਜੀ